ਭੰਗੜਾ ਐਰੋਬਿਕਸ ਵਿੱਚ ਭਵਿੱਖ ਵਿੱਚ ਇੱਕ ਪ੍ਰਸਿੱਧ ਫਿਟਨੈਸ ਰੁਝਾਨ ਬਣਨ ਦੀ ਮਜ਼ਬੂਤ ਸੰਭਾਵਨਾ ਹੈ ਇਹ ਵਿਲੱਖਣ ਕਸਰਤ ਹੈ ਰਵਾਇਤੀ ਪੰਜਾਬੀ ਡਾਂਸ ਵਿੱਚ ਉੱਚ ਊਰਜਾ ਵਾਲੀਆਂ ਹਰਕਤਾਂ ਨੂੰ ਐਰਬਿਕ ਕਸਰਤ ਨਾਲ ਜੋੜਦੀ ਹੈ ਜੋ ਫਿਟ ਰਹਿਣ ਵਿੱਚ ਇੱਕ ਦਿਲਚਸਪ ਅਤੇ ਪ੍ਰਭਾਵਸ਼ਾਲੀ ਤਰੀਕਾ ਬਣਾਉਂਦੀ ਹੈ ਜੁੰਬਾ ਬੋਲੀਵੁੱਡ ਡਾਂਸ ਫਿਟਨੈਸ ਅਤੇ ਹਿਪਹੋਪ ਐਰੋਬਿਕਸ ਵਰਗੇ ਹੋਰ ਡਾਂਸ ਅਧਾਰਿਤ ਵਰਕ ਆਊਟ ਦੀ ਵਿ ਵਿਸ਼ਵ ਵਿਆਪੀ ਸਫਲਤਾ ਨੂੰ ਦੇਖਦੇ ਹੋਏ ਭੰਗੜਾ ਐਰੋਬਿਕਸ ਵੀ ਇਸੇ ਤਰ੍ਹਾਂ ਦੇ ਰਸਤੇ 'ਤੇ ਚੱਲ ਸਕਦਾ ਹੈ ਇਸ ਦੀ ਸੰਭਾਵੀ ਪ੍ਰਸਿੱਧੀ ਦਾ ਇੱਕ ਮੁੱਖ ਕਾਰਨ ਇਸ ਦਾ ਮਜ਼ੇਦਾਰ ਅਤੇ ਦਿਲ ਦਿਲਚਸਪ ਸੁਭਾਅ ਹੈ ਇੱਕ ਸਾਰ ਵਰਕ ਆਊਟ ਦੇ ਉਲਟ ਭੰਗੜਾ ਐਰੋਬਿਕਸ ਕਸਰਤ ਵਿੱਚ ਇੱਕ ਡਾਂਸ ਪਾਰਟੀ ਵਾਂਗ ਮਹਿਸੂਸ ਕਰਦਾ ਹੈ ਜੋ ਇਸ ਨੂੰ ਸਾਰੇ ਫਿਟਨੈਸ ਪੱਧਰਾਂ 'ਤੇ ਲੋਕਾਂ ਲਈ ਮਜ਼ੇਦਾਰ ਬਣਾਉਂਦਾ ਹੈ ਉਤਸ਼ਾਹਿਤ ਪੰਜਾਬੀ ਸੰਗੀਤ ਅਤੇ ਤਾਲਬੱਧ ਚਾਲਾਂ ਭਾਗੀਦਾਰਾਂ ਨੂੰ ਕੈਲੋਰੀ ਸਾੜਦੇ ਹੋਏ ਪ੍ਰੇਰਿਤ ਕਰਦੇ ਪ੍ਰੇਰਿਤ ਰਹਿਣ ਵਿੱਚ ਮਦਦ ਕਰਦੀਆਂ ਹਨ ਇਸ ਤੋਂ ਇਲਾਵਾ ਭੰਗੜੇ ਦੀਆਂ ਹਰਕਤਾਂ ਵਿੱਚ ਪੂਰੇ ਸਰੀਰ ਦੀ ਸ਼ਮੂਲੀਅਤ ਦਿਲ ਅਤੇ ਦਿਲ ਦੀ ਸਹਿਣਸ਼ੀਲਤਾ ਅਤੇ ਤਾਕਤ ਅਤੇ ਤਾਲਮੇਲ ਵਿੱਚ ਸੁਧਾਰ ਸ਼ਾਮਿਲ ਹੈ ਇੱਕ ਹੋਰ ਕਾਰਨ ਹੈ ਜੋ ਇਸ ਵਿਕਾਸ ਨੂੰ ਚਲਾ ਸਕਦਾ ਹੈ ਉਹ ਹੈ ਤੰਦਰੁਸਤੀ ਵਿੱਚ ਵੱਧਦੀ ਸੱਭਿਆਚਾਰਕ ਪ੍ਰਸ਼ੰਸ਼ਾ ਅਤੇ ਫਿਊਜ਼ਨ ਰੁਝਾਨ ਜਿਵੇਂ ਜਿਵੇਂ ਦੁਨੀਆਂ ਹੋਰ ਆਪਸ ਵਿੱਚ ਜੁੜਦੀ ਜਾਂਦੀ ਹੈ ਲੋਕ ਡਾਂਸ ਰੂਪ ਸਮੇਤ ਵਿਭਿੰਨ ਸਭਿਆਚਾਰਾਂ ਅਭਿਆਸਾਂ ਅਤੇ ਅਪ ਨੂੰ ਅਪਣਾ ਰਹੇ ਹਨ ਭੰਗੜੇ ਦੀ ਜੀਵਨ ਊਰਜਾ ਅਤੇ ਅਮੀਰ ਵਿਰਸੇ ਵ ਵਿਰਾਸਤ ਇਸ ਨੂੰ ਦੁਨੀਆਂ ਭਰ ਦੇ ਫਿਟਨੈਸ ਉਤਸ਼ਾਹੀਆਂ ਲਈ ਇੱਕ ਆਕਰਸ਼ਕ ਵਿਕਲਪ ਬਣਾਉਂਦੀ ਹੈ